ਮੈਂ ਇੱਕ ਰਸ਼ੀਅਨ ਨਾਵਲ ਮੇਰਾ ਦਾਗੀਸਤਾਨ ਜੋ ਕਿ ਲੇਖਕ ਰਸੂਲ ਹਮਜਾ ਤੂਬ ਦੀ ਲਿਖੀ ਹੋਈ ਹੈ ਅਤੇ ਪੰਜਾਬੀ ਵਿੱਚ ਅਨੁਵਾਦਿਤ ਹੈ ਨੂੰ ਪੜ੍ਹਿਆ ਹੈ ਇਹ ਕਿਤਾਬ ਬਹੁਤ ਹੀ ਜ਼ਿਆਦਾ ਅੱਛੀ ਹੈ ਇਹ ਤਿੰਨ ਭਾਗਾਂ ਦੇ ਵਿੱਚ ਆਈ ਹੋਈ ਹੈ ਇਸ ਕਿਤਾਬ ਨੂੰ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿ ਜੋ ਤੁਹਾਡਾ ਆਪਣਾ ਮੂਲ ਦੇਸ਼ ਹੈ ਮੂਲ ਪਿੰਡ ਹੈ ਜਾਂ ਫਿਰ ਜੋ ਤੁਹਾਡੀ ਆਪਣੀ ਭਾਸ਼ਾ ਹੈ ਉਹ ਸਭ ਤੋਂ ਉੱਪਰ ਹੈ ਅਗਰ ਤੁਸੀਂ ਆਪਣੀ ਮੂਲ ਭਾਸ਼ਾ ਨੂੰ ਤਵੱਜੋ ਨਹੀਂ ਦਿਉਗੇ ਤਾਂ ਦੁਨੀਆ ਦੇ ਵਿੱਚ ਕੋਈ ਵੀ ਤੁਹਾਨੂੰ ਅਲੱਗ ਤੋਂ ਤਵੱਜੋ ਨਹੀਂ ਦਊਗਾ ਇਸੇ ਤਰ੍ਹਾਂ ਹੀ ਜਿਸ ਤੁਹਾਡਾ ਜੋ ਮੂਲ ਰਹਿਣ ਵਾਲਾ ਜੋ ਇਲਾਕਾ ਹੈ ਉਹ ਹੀ ਉਸ ਦੇ ਨਾਲ ਤੁ ਤੁਹਾਡਾ ਪਿਆਰ ਹੀ ਤੁਹਾਡੀ ਜਿਹੜੀ ਸ਼ਖਸੀਅਤ ਹੈ ਉਹ ਬਿਆਨ ਕਰਦਾ ਹੈ ਮੇਰਾ ਇਸ ਕਿਤਾਬ ਨੂੰ ਪੜ੍ਹ ਕੇ ਇੱਕ ਬਹੁਤ ਹੀ ਵੱਖਰਾ ਤਜ਼ਰਬਾ ਹੋਇਆ ਇਸ ਤਰ੍ਹਾਂ ਹੀ ਪੰਜਾਬੀ ਦੇ ਵਿੱਚ ਵੀ ਬਹੁਤ ਬਹੁਤ ਸਾਰੀਆਂ ਕਿਤਾਬਾਂ ਹਨ ਜਿਨ੍ਹਾਂ ਨੂੰ ਕਿ ਹੋਰ ਭਾਸ਼ਾਵਾਂ ਦੇ ਵਿੱਚ ਅਨੁਵਾਦਿਤ ਕਰਨਾ ਕਾਫੀ ਜ਼ਰੂਰੀ ਹੈ ਇਸ ਤਰ੍ਹਾਂ ਸੰਸਾਰ ਪੱਧਰ 'ਤੇ ਪੰਜਾਬ ਦੀਆਂ ਲਿਖਤਾਂ ਵੀ ਦੂਜੀਆਂ ਭਾਸ਼ਾਵਾਂ ਦੇ ਵਿੱਚ ਲੋਕਾਂ ਤੱਕ ਪਹੁੰਚਾਉਣੀਆਂ ਜਾਣੀਆਂ ਚਾਹੀਦੀਆਂ ਹਨ ਇਹਨਾਂ ਵਿੱਚੋ ਇੱਕ ਨਾਵਲ ਜੋ ਕਿ ਅੰਮ੍ਰਿਤਾ ਪ੍ਰੀਤਮ ਦੁਆਰਾ ਲਿਖਿਆ ਹੋਇਆ ਪਿੰਜਰ ਹੈ ਇਸ ਦੇ ਵਿੱਚ ਇੱਕ ਔਰਤ ਦੀ ਕਹਾਣੀ ਹੈ ਜੋ ਕਿ ਖਾਨਦਾਨੀ ਦੁਸ਼ਮਣੀ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਉਸਦਾ ਵਿਆਹ ਜਿਹੜਾ ਹੈ ਉਹ ਵੱਖਰੇ ਧਰਮ ਦੇ ਵਿੱਚ ਹੋ ਜਾਂਦਾ ਹੈ ਉਹਦਾ ਧਰਮ ਬਦਲਿਆ ਜਾਂਦਾ ਹੈ ਉਸ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਜੋ ਵੰਡ ਹੈ ਉੱਨੀ ਸੌ ਸੰਤਾਲੀ ਵੇਲੇ ਦੀ ਉਸਦਾ ਦਰਦ ਵੀ ਬਿਆਨ ਕਰਦੀ ਹੈ ਕਿ ਕਿਸ ਤਰ੍ਹਾਂ ਉਸ ਨੂੰ ਜ਼ਿੰਦਗੀ ਦੇ ਵਿੱਚ ਕਿੰਨੀਆਂ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ